ਧਰਮ ਸਾਡੇ ਖਿੱਤੇ ਵਿੱਚ ਸੈਰ ਸਪਾਟੇ ਨੂੰ ਬਹੁਤ ਪ੍ਰਭਾਵਿਤ ਕਰਦਾ ਹੈ ਸਾਡੇ ਦੇਸ਼ ਵਿੱਚ ਬਹੁਤ ਅਜਿਹੀਆਂ ਜਗ੍ਹਾ ਬਣੀਆਂ ਹੋਈਆਂ ਹਨ ਜਿੱਥੇ ਲੋਕ ਸੈਰ ਸਪਾਟਾ ਕਰਨ ਵੀ ਆਉਂਦੇ ਹਨ ਅਤੇ ਇੱਥੇ ਘੁੰਮਣ ਫਿਰਨ ਅਤੇ ਮੱਥਾ ਟੇਕਣ ਵੀ ਆਉਂਦੇ ਹਨ ਸਾਡੇ ਸ਼ਹਿਰ ਵਿ ਸਾਡੇ ਦੇਸ਼ ਵਿੱਚ ਬਹੁਤ ਸਾਰੇ ਅਜਿਹੀਆਂ ਜਗ੍ਹਾ ਹਨ ਜਿੱਥੇ ਲੋਕ ਬਾਹਰ ਦੂਰੋਂ ਦੂਰੋਂ ਲੋਕ ਆਉਂਦੇ ਹਨ ਸਾਡੇ ਦੇਸ਼ ਵਿੱਚ ਇੱਕ ਅੰਮ੍ਰਿਤਸਰ ਵਿਖੇ ਗੁਰੂ ਸ਼੍ਰੀ ਗੁਰੂ ਰਾਮਦਾਸ ਜੀ ਗੁਰੂਆਂ ਦੇ ਚੌਥੇ ਗੁਰੂ ਇੱਕ ਪੰਜ ਸੱਤ ਚਾਰ ਵਿੱਚ ਉਹਨਾਂ ਨੇ ਇਹ ਗੁਰੂ ਘਰ ਵਸਾਇਆ ਇਹ ਸ਼ਹਿਰ ਵਸਣ ਤੋਂ ਪਹਿਲਾਂ ਗੁਰੂ ਘਰ ਦੀ ਸਥਾਪਨਾ ਹੋਈ ਸੀ ਅਤੇ ਸ਼੍ਰੀ ਗੁਰੂ ਰਾਮਦਾਸ ਜੀ ਨੇ ਇਸ ਦੇ ਚਾਰ ਦਰਵਾਜੇ ਰਖਵਾਏ ਤਾਂ ਜੋ ਚਾਰੇ ਧਰਮਾਂ ਦੇ ਵਿੱਚੋਂ ਕੋਈ ਵੀ ਇੱਥੇ ਆ ਕੇ ਇੱਥੇ ਆ ਸਕਦਾ ਹੈਗਾ ਇਹ ਸਿਰਫ ਸਿੱਖਾਂ ਨਾਲ ਹੀ ਨਹੀਂ ਬਲਕਿ ਇਹ ਸਾਰੇ ਧਰਮਾਂ ਨਾਲ ਸੰਬੰਧ ਰੱਖਦੇ ਹਨ ਧੰਨਵਾਦ